ਸਤਿ ਸ਼੍ਰੀ ਅਕਾਲ ਮੈਂ ਗਗਨਪ੍ਰੀਤ ਕੌਰ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਪਠਾਨਕੋਟ ਵਿੱਚ ਗਰਮੀਆਂ ਦਾ ਮੌਸਮ ਸਭ ਤੋਂ ਵਧੀਆ ਲਈ ਮੰਨਿਆ ਜਾਂਦਾ ਹੈ ਅਤੇ ਗਰਮੀਆਂ ਦੇ ਮੌਸਮ ਵਿੱਚ ਲੋਕ ਘੁੰਮਣ ਫਿਰਨ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਫੈਮਲੀ ਮਤਲਬ ਟਰਿਪ ਵੀ ਹੁੰਦੀ ਹੈ ਜਿੱਦਾਂ ਮਿੰਨੀ ਗੋਆ ਵਿੱਚ ਜਾ ਕੇ ਲੋਕ ਉੱਥੇ ਘੁੰਮਦੇ ਫਿਰਦੇ ਹਨ ਸਾਰੀ ਫੈ ਫੈਮਲੀ ਜਾਂਦੀ ਹੈ ਅਤੇ ਇੱਥੇ ਰਣਜੀਤ ਸਾਗਰ ਡੈਮ ਆ ਉੱਥੇ ਲੋਕ ਘੁੰਮਣ ਫਿਰਨ ਜਾਂਦੇ ਹਨ ਅਤੇ ਜਿਵੇਂ ਕਿ ਅ ਮੇਲੇ ਇੱਥੇ ਪਨ ਬਹੁਤ ਜ਼ਿਆਦਾ ਲੱਗਦੇ ਹਨ ਪਠਾਨਕੋਟ ਵਿੱਚ ਮੇਲਿਆਂ ਵਿੱਚ ਇੱਥੇ ਲੋਹੜੀ ਦਾ ਮੇਲਾ ਹੁੰਦਾ ਹੈ ਅਤੇ ਵਿਸਾਖੀ ਦਾ ਮੇਲਾ ਹੁੰਦਾ ਹੈ ਅਤੇ ਨਾਗਣੀ ਦਾ ਮੇਲਾ ਨਾਗਰੀ ਮਾਤਾ ਦਾ ਮੇਲਾ ਹੁੰਦਾ ਹੈ ਇਹ ਮਾ ਨਾਗਰੀ ਮਾਤਾ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਅਤੇ ਮੇਲਿਆਂ ਵਿੱਚ ਮਤਲਬ ਕਿ ਕੁਛ ਸੱਭਿਆਚਾਰਿਕ ਖੇਡਾਂ ਵਗੈਰਾ ਜਾਂਦਾ ਜਿਵੇਂ ਕਿ ਕਬੱਡੀ ਅਤੇ ਮੇਲਿਆਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਲੱਗਦੀਆਂ ਹਨ ਜਿਵੇਂ ਕਿ ਖਿਡੌਣਿਆਂ ਦੀਆਂ ਅਤੇ ਬੱਚੇ ਖਿਡੌਣਿਆਂ ਦੀ ਦੁਕਾਨਾਂ ਬੱਚਿਆਂ ਨੂੰ ਵੀ ਮੇਲਿਆਂ ਦਾ ਬਹੁਤ ਚਾਅ ਹੁੰਦਾ ਹੈ ਕਿਉਂਕਿ ਉੱਥੇ ਖਿਡੌਣੇ ਵਗੈਰਾ ਲੱਗਦੇ ਹਨ ਅਤੇ ਥੋੜ੍ਹਾ ਖੇਡਾਂ ਵਗੈਰਾ ਬਾਰੇ ਸਾ ਸੱਭਿਆਚਾਰਿਕ ਖੇਡਾਂ ਵਗੈਰਾ ਬਾਰੇ ਦੱਸਿਆ ਜਾਂਦਾ ਹੈ ਅਤੇ ਇੱਥੇ ਖਾਣ ਪੀਣ ਦਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਖਾਣ ਪੀਣ ਦੇ ਗੋਲ ਗੱਪੇ ਅਤੇ ਮਿਠਾਈਆਂ ਇਹ ਜਾ ਸਾਰਾ ਕੁਛ ਲੱਗਦਾ ਹੈ ਅਤੇ ਮਤਲਬ ਕਿ ਇੱਥੇ ਲੋਕ ਖਾਣ ਪੀਣ ਦਾ ਵੀ ਆਨੰਦ ਮਾਣਦੇ ਹਨ ਅਤੇ ਉਹ ਸਵੇਰੇ ਮਤਲਬ ਕਿ ਸ਼ਾ ਚਾਰ ਕੁ ਵਜੇ ਸ਼ਾਮੀ ਆ ਜਾਂਦੇ ਮੇਲਿਆਂ ਵਿੱਚ ਅਤੇ ਰਾਤ ਸੱਤ ਅੱਠ ਵਜੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ